ਹਾਂਜੀ ਬਲੈਕ ਐਂਡ ਐਂਡ ਵਾਈਟ ਫੋਟੋਗ੍ਰਾਫੀ ਦਾ ਬਹੁਤ ਪ੍ਰਯੋਗ ਕੀਤਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਭਾਵੇਂ ਕਲਰ ਪਰ ਫੋਟਮਾ ਆ ਗਈਆਂ ਨੇ ਪਰ ਜਦੋਂ ਪੁਰਾਤਨ ਸਮੇਂ ਦੇ ਵਿੱਚ ਕੁਝ ਸਮਾਂ ਪਹਿਲਾਂ ਦੇਖਿਆ ਜਾਵੇ ਤਾਂ ਬਲੈਕ ਐਂਡ ਵਾਈਟ ਫੋਟੋਗ੍ਰਾਫੀ ਦਾ ਜੋ ਕੰਮ ਸੀ ਬਹੁਤ ਚੰਗਾ ਸੀ ਜੋ ਕਲਰਫੁੱਲ ਫੋਟੋਆਂ ਨੇ ਉਹ ਸਾਡੇ ਅੱਖਾਂ ਨੂੰ ਵੀ ਕਈ ਵਾਰ ਨੁਕਸਾਨ ਕਰਦੀਆਂ ਨੇ ਜੋ ਬਲੈਕ ਐਂਡ ਵਾਈਟ ਫੋਟੋਆਂ ਸੀ ਉਹ ਬਹੁਤ ਸੋਹਣੀਆਂ ਵੀ ਲੱਗਦੀਆਂ ਸੀ ਪਿਆਰੀਆਂ ਵੀ ਲੱਗਦੀਆਂ ਸੀ ਮੈਂ ਅੱਜ ਵੀ ਆਪਣੀਆਂ ਕਈ ਫੋਟੋਆਂ ਕਲਰਫੁੱਲ ਤੋਂ ਬਲੈਕ ਐਂਡ ਵਾਈਟ ਦੇ ਵਿੱਚ ਬਦਲ ਰਿਹਾ ਹਾਂ ਤਾਂ ਜੋ ਉਹ ਦੀਵਾਰ 'ਤੇ ਵੀ ਲੱਗੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਸੋ ਇਸ ਕਰਕੇ ਉਹ ਫੋਟੋਆਂ ਬਹੁਤ ਹੀ ਜ਼ਿਆਦਾ ਪਿਆਰੀਆਂ ਲੱਗਦੀਆਂ ਨੇ ਜੋ ਬਲੈਕ ਐਂਡ ਵੈਟ ਫੋਟੋ ਉਹਦੇ ਵਿੱਚ ਇੱਕ ਕੁਦਰਤੀ ਝਲਕ ਦਿਸਦੀ ਹੈ ਜਿਵੇਂ ਇੱਕ ਕੁਦਰਤ ਦਾ ਇੱਕ ਕਰਿਸ਼ਮਾ ਹੋਵੇ ਉਹ ਫੋਟੋ ਦੇ ਵਿੱਚ ਇੱਕ ਕੁਦਰਤੀ ਰੰਗ ਦਿਸਦੇ ਨੇ ਸੋ ਇਸ ਕਰਕੇ ਜੋ ਬਲੈਕ ਐਂਡ ਵੈਟ ਫੋਟੋਗ੍ਰਾਫੀ ਹੈ ਉਹ ਬਹੁਤ ਸੋਹਣੀ ਅਤੇ ਸੁੰਦਰ ਲੱਗਦੀ ਹੈ